ਹੈਲੋ ਹਾਂਜੀ ਸਰ ਮੈਂ ਤੁਹਾਨੂੰ ਪੁੱਛਣਾ ਸੀ ਵੀ ਤੁਸੀਂ ਬੁੱਕ ਸੈਂਟਰ ਤੋਂ ਬੋਲ ਰਹੇ ਹੋ ਹਾਂਜੀ ਸਰ ਮੈਂ ਨਾ ਬੁੱਕ ਆਰਡਰ ਕਰਨੀ ਹੈ ਪਰੀ ਆਰਡਰ ਕਰਨੀ ਹੈ ਅਤੇ ਮੈਨੂੰ ਆਰਡਰ ਤੋਂ ਨਾ ਪਹਿਲਾਂ ਚਾਹੀਦੀ ਹੈ ਬੁੱਕ ਕੀ ਮੈਨੂੰ ਮਿਲ ਜਾਵੇਗੀ ਹਾਂਜੀ ਕੇ ਕਿਹੜੀ ਕਿਹੜੀ ਲੈਂਗੁਏਜ ਚ ਹੈਗੀਆਂ ਨੇ ਤੁਹਾਡੇ ਕੋਲ ਬੁੱਕਸ ਮੈਨੂੰ ਮੈਥ ਅਤੇ ਇੰਗਲਿਸ਼ ਓਹ ਪੰਜਾਬੀ ਦੀ ਚਾਹੀਦੀ ਹੈ ਮੈਥ ਅਤੇ ਪੰਜਾਬੀ ਦੋਵਾਂ ਲਈ ਹਾਂਜੀ ਹਾਂਜੀ ਅਤੇ ਮੈਂ ਮੈਥ ਦੀ ਮੈਨੂੰ ਇੰਗਲਿਸ਼ ਮੀਡੀਅਮ 'ਚ ਮਿਲ ਸਕਦੀ ਹੈ ਆਰ ਐੱਸ ਅਗਰਵਾਲ ਹੀ ਸਹੀ ਰਹੇਗਾ

ਹੋਰ ਬਸ ਆਹ ਪੰਜਾਬੀ ਜਿਵੇਂ ਲੈਂਗੁਏਜ ਵੈਸੀ ਚਾਹੀਦੀ ਹੈ ਹਾਂਜੀ ਨਹੀਂ ਸਰ ਬਾਕੀ ਤਾਂ ਹੋਰ ਨਹੀਂ ਬਸ ਇਹ ਦੋ ਬੁੱਕ ਚਾਹੀਦੀ ਹੈ ਅਤੇ ਜਿਹੜੀ ਮੈਥ ਦੀ ਬੁੱਕ ਹੈਗੀ ਉਹ ਬਾਏਲੈਗੁਏਜ ਮਿਲ ਜਾਵੇਗੀ ਤੁਹਾਡੇ ਕੋਲ ਬਾਈਲੈਗਏਲ ਯਾਨੀ ਕਿ ਦੋਵਾਂ ਲੈਂਗੁਏਜ ਵਿੱਚ ਹੋਏ ਪੰਜਾਬੀ ਅਤੇ ਇੰਗਲਿਸ਼ ਦੋਵੇਂ ਵਿੱਚ ਹੋਵੇ

ਅ ਅੱਛਾ ਠੀਕ ਹੈ ਸਰ ਅਤੇ ਮੈਨੂੰ ਪ੍ਰਾਈਜ ਪ੍ਰਾਈਜ ਦਾ ਤੁਸੀਂ ਥੋੜ੍ਹਾ ਦੱਸ ਦਿਓ ਵੀ ਕਿੰਨੇ ਕਿੰਨੇ ਦੀ ਵੀ ਪਵੇਗੀ ਮੈਨੂੰ ਦੋਵੇਂ ਅੱਛਾ ਅੱਛਾ ਅੱਛਾ ਅੱਛਾ ਠੀਕ ਠੀਕ ਹੈ ਸਰ ਅਤੇ ਜਿਹੜੀ ਬੁੱ ਬੁੱਕ ਦਾ ਉਹ ਜਿਹੜਾ ਕੁਆਂਟਿਟੀ ਹੋਵੇਗੀ ਉਹ ਕਿੰਨੀ ਮਤਲਬ ਜਿਵੇਂ ਪੇਜ ਕੁਝ ਫਟੇ ਨਾ ਹੋਣ ਵਿਚਾਲੇ ਕੁਝ ਗਾਇਬ ਮਿਸਪ੍ਰਿੰਟ ਨਾ ਹੋਵੇ ਅਤੇ ਉਹ ਸਭ ਰਿਸਪੋਂਸੀਬਿਲਟੀ ਤੁਹਾਡੀ ਹੋਵੇਗੀ

ਹਾਂਜੀ ਅੱਛਾ ਠੀ ਠੀਕ ਹੈ ਸਰ ਠੀਕ ਠੀਕ ਹੈ ਸਰ ਇਹ ਬੁੱਕਸ ਮੈਂ ਹੁਣੇ ਆਰਡਰ ਕਰ ਦਿੰਦੀ ਹਾਂ ਅਤੇ ਮੈਨੂੰ ਨਾ ਉਹ ਜਿਹੜੀ ਆਰਡਰ ਡੇਟ ਲਿਖੀ ਉਸ ਤੋਂ ਪਹਿਲਾਂ ਚਾਹੀਦੀ ਹ ਕਿਉਂਕਿ ਮੇਰਾ ਇੱਕ ਵਾਰ ਪਹਿਲਾਂ ਵੀ ਨਾ ਇਗਜ਼ਾਮ ਰਹਿ ਗਿਆ ਸੀ ਇਵੇਂ ਮੈਂ ਬੁੱਕ ਆਰਡਰ ਕੀਤੀ ਸੀ ਅਤੇ ਉਹ ਟਾਈਮ 'ਤੇ ਪਹੁੰਚ ਹੀ ਨਹੀਂ ਮੇਰੇ ਕੋਲ ਅਤੇ ਮੇਰਾ ਇਗਜ਼ਾਮ ਵੀ ਰਹਿ ਗਿਆ ਵਿਚਾਲੇ ਹਾਂਜੀ ਹਾਂਜੀ ਠੀਕ ਹੈ ਸਰ ਜਿਵੇਂ ਉਹ ਤੁਹਾਨੂੰ ਸਹੀ ਲੱਗਦਾ ਪਰ ਮੈਨੂੰ ਨਾ ਉਹ ਟਾਈਮ ਤੋਂ ਪਹਿਲਾਂ ਚਾਹੀਦੀ ਹੈ

ਹਾਂ ਉਹ ਤੁਸੀਂ ਜਿਵੇਂ ਆਨਲਾਈਨ ਕਰਵਾਉਣੀ ਤਾਂ ਆਨਲਾਈਨ ਕਰਵਾ ਲੈਦੇ ਹਾਂ ਹਾਂਜੀ ਚੱਲ ਠੀ ਠੀਕ ਹੈ ਸਰ ਉਹ ਤਾਂ ਕੋਈ ਗੱਲ ਨਹੀਂ ਅਤੇ ਤੁਸੀਂ ਹਾਂਜੀ ਅੱਛਾ ਠੀਕ ਹੈ ਸਰ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਥੈਂਕ ਯੂ ਸਰ ਥੈਂਕ ਯੂ